ਟੈਕਨਾਲੋਜੀ ਸਾਡੇ ਰਹਿਣ ਦੇ ਤਰੀਕੇ ਸਾਡੇ ਬੋਲਣ ਦੇ ਤਰੀਕੇ ਸਾਡੇ ਰੋਜ਼ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਰਹੀ ਹੈ ਅਤੇ ਸਾਡੇ ਸਾਡੇ ਵਾਤਾਵਰਨ ਨੂੰ ਦੂਸ਼ਿਤ ਵੀ ਕਰ ਰਹੀ ਹੈ ਮੋਬਾਇਲ ਟੈਕਨੋਲੋਜੀ ਸਾਡੇ ਵਾਤਾਵਰਣ ਨੂੰ ਬੱਚਿਆਂ ਦੀ ਗਰੋਥ ਨੂੰ ਪੰਛੀਆਂ ਨੂੰ ਖਰਾਬ ਕਰ ਰਹੀ ਹੈ ਈ ਵੇਸਟ ਜਿਹੜਾ ਟੈਕਨੋਲੋਜੀ ਦੇ ਨਾਲ ਬਣ ਰਿਹਾ ਹੈ ਉਹਨੂੰ ਦੁਬਾਰਾ ਵਰਤੋਂ ਵਿੱਚ ਨਹੀਂ ਲੈ ਕੇ ਆਇਆ ਜਾ ਸਕਦਾ ਹੈ ਜਿਹਦੇ ਨਾਲ ਸਾਰਾ ਈ ਵੇਸਟ ਸਮੁੰਦਰ ਵਿੱਚ ਸੁੱਟਿਆ ਜਾ ਰਿਹਾ ਹੈ ਜਿਹਦੇ ਨਾਲ ਪਾਣੀ ਖਰਾਬ ਕੀਤਾ ਜਾ ਰਿਹਾ ਹੈ ਟੈਕਨੋਲੋਜੀ ਦੇ ਫਾਇਦੇ ਵੀ ਨੇ ਟੈਕਨੋਲੋਜੀ ਦਾ ਨੁਕਸਾਨ ਵੀ ਹੈ ਟੈਕਨੋਲੋਜੀ ਸਾਨੂੰ ਨਵੇਂ ਤਰੀਕੇ ਨਾਲ ਕੰਮ ਕਰਨ ਦਾ ਤਰੀਕੇ ਸਿਖਾ ਰਹੀ ਹੈ ਲੇਕਿਨ ਸਾਨੂੰ ਆਪਣਿਆਂ ਨਾਲ ਦੂਰ ਕਰ ਰਹੀ ਹੈ ਟੈਕਨੋਲੋਜੀ ਨਾਲ ਅਸੀਂ ਵੇਸਟ ਜਿਆਦਾ ਬਣਾਏ ਬਣਾ ਰਹੇ ਹਾਂ ਜਿਹਦੇ ਨਾਲ ਅਸੀਂ ਉਹਨੂੰ ਮੁੜ ਵਰਤੋਂ ਨਹੀਂ ਕਰ ਸਕਦੇ ਜਿਹਦੇ ਨਾਲ ਉਹਦੀ ਸੰਭਾਲ ਉਹਨੂੰ ਰੱਖ ਰਖਾਵ ਉਸ ਉਸ ਰੱਖ ਰਖਾਵ 'ਤੇ ਖਰਚਾ ਬਹੁਤ ਜ਼ਿਆਦਾ ਆ ਰਿਹਾ ਹੈ ਟੈਕਨੋਲੋਜੀ ਦੇ ਜਿਹੜੇ ਖਰਾਬ ਸਮਾਨ ਨੇ ਅਸੀਂ ਉਹਨੂੰ ਮੁੜ ਤੋਂ ਯੂਜ ਨਹੀਂ ਕਰ ਸਕਦੇ ਹਾਂ ਜਿਹਦੇ ਨਾਲ ਉਹਨੂੰ ਅਸੀਂ ਸਮੁੰਦਰ ਵਿੱਚ ਫੇਂਕ ਦਿੰਦੇ ਹਾਂ ਜਾਂ ਉਹਨੂੰ ਕੂੜਾ ਕਰਕਟ ਵਾਂਗੂੰ ਕਿਥੇ ਰੱਖ ਦਿੰਦੇ ਹਾਂ ਜੋ ਕਿ ਇੱਕ ਵਿਸ਼ਾਲ ਰੂਪ ਧਾਰਨ ਕਰ ਰਿਹਾ ਹੈ ਜਿਹਦੇ ਨਾਲ ਸਾਡਾ ਪਰਿਆਵਰਨ ਬਹੁਤ ਹੀ ਦੂਸ਼ਿਤ ਹੋ ਰਿਹਾ ਹੈ